ਹੈਲੋ ਡਾਕਟਰ ਸਾਹਿਬ ਸਪੈਸ਼ਲੀ ਮੈਨੇ ਤੁਹਾਨੂੰ ਬੋਲਿਆ ਸੀ ਕਿ ਤੁਹਾਡੀ ਪੇਟ 'ਚ ਇਨਫੈਕਸ਼ਨ ਹੈਗੀ ਹੈ ਤੁਸੀਂ ਬਾਹਰ ਦਾ ਘੱਟ ਖਾਣਾ ਤੁਸੀਂ ਬਾਹਰ ਦਾ ਘੱਟ ਖਾਣਾ ਸ਼ੁਰੂ ਕੀਤਾ ਕਿ ਨਹੀਂ ਤੇ ਉਹੀ ਤੇ ਸਾਡੀ ਸਭ ਤੋਂ ਜਿਆਦਾ ਪਰੇਸ਼ਾਨੀ ਹੈ ਕਿ ਤੁਹਾਨੂੰ ਆਪਣੇ ਜੁਬਾਨ ਦਾ ਕੰਟਰੋਲ ਘੱਟ ਕਰਨਾ ਹੈਗਾ ਆ ਤੁਹਾਨੂੰ ਦੇਖਣਾ ਹ ਕਿ ਤੁਹਾਨੂੰ ਕਿਹੜੀ ਚੀਜ਼ ਖਾਣੀ ਚਾਹੀਦੀ ਕਿਹੜੀ ਚੀਜ਼ ਨਹੀਂ ਖਾਣੀ ਤੁਹਾਨੂੰ ਸਭ ਤੋਂ ਜਿਆਦਾ ਹਰੀ ਚੀਜਾਂ ਖਾਣੀ ਚਾਹੀਦੀਆਂ ਆ ਇਦਾਂ ਕਿੱਦਾਂ ਘਰ ਦੀ ਚੀਜ਼ਾਂ ਖਾ ਕੇ ਕਦੇ ਵੀ ਕਿਸੇ ਦਾ ਢਿੱਡ ਨਹੀਂ ਦੁੱਖਦਾ ਹੈਗਾ ਤੁਹਾਨੂੰ ਸਭ ਤੋਂ ਜਿਆਦਾ ਘਰ ਦੀ ਚੀਜ਼ਾਂ ਹੀ ਖਾਣੀ ਚਾਹੀਦੀ ਤੁਹਾਨੂੰ ਬਾਹਰ ਦੇ ਪੀਜ਼ੇ ਵਗੈਰਾ ਸਭ ਕੁਝ ਬੰਦ ਕਰਨੇ ਪੈਣੇ ਆ ਥਾਨੂੰ ਮਸਾਲੇ ਵਾਲੀ ਚੀਜ਼ਾਂ ਪਸੰਦ ਹੈ ਇਸਮੇਂ ਮੈਂ ਤੁਹਾਨੂੰ ਕਹਿ ਰਹੀ ਕਿ ਤੁਹਾਨੂੰ ਮਸਾਲਾ ਥੋੜਾ ਜਿਹਾ ਘੱਟ ਖਾਣਾ ਵੀ ਘੱਟ ਖਾਓਗੇ ਤੁਸੀਂ ਜਿਆਦਾਤਰ ਲਿਕੁਅਡ ਚੀਜ਼ਾਂ ਪੀਓ ਤੁਹਾਡੇ ਪੇਟ ਦੀ ਇੰਨਫੈਕਸ਼ਨ ਵੀ ਘੱਟ ਹੋਵੇ ਤੁਹਾਡਾ ਰੈਫਰੈਂਸ ਬਰੇਕ ਦੇ ਸਿਸਟਮ ਵੀ ਤੁਹਾਡਾ ਸਹੀ ਹੋ ਜਵੇ ਮੈਂ ਤੁਹਾਨੂੰ ਦੱਸਿਆ ਤੁਸੀਂ ਨਾ ਸਭ ਤੋਂ ਪਹਿਲਾਂ ਕਰੋ ਕਿ ਤੁਸੀਂ ਸਵੇਰੇ ਸਵੇਰੇ ਉੱਠ ਕੇ ਗਰਮ ਪਾਣੀ ਪੀਓ ਫਿਰ ਨਾ ਤੁਹਾਡਾ ਪੇਟ ਇਕਦਮ ਸਾਫ ਰਹੇਗਾ ਦੋ ਦਿਨ ਬਾਅਦ ਆ ਕੇ ਤੁਸੀਂ ਮੈਨੂੰ ਦੱਸਦੋ ਪਰ ਮੇਰੀ ਗੱਲ ਸੁਣੋ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਗਰਮ ਪਾਣੀ ਪੀਣਾ ਤੁਹਾਨੂੰ ਜੋਗਾ ਕਰਨੀ ਹੈ ਤੁਹਾਨੂੰ ਐਕਸੈਸ ਕਰਨਾ ਤਾਂ ਕੀ ਤੁਹਾਡੀ ਬਾਡੀ ਵੀ ਚੁਸਤ ਚੁਸਤ ਰਵੇ ਤੰਦ ਤੰਦਰੁਸਤ ਰਵੇ ਹਾਂ ਤੁਸੀਂ ਬਸ ਇਹੀ ਉਮੀਦ ਕਰੋ ਤੁਹਾਨੂੰ ਨਾ ਇਹ ਦਵਾਈਆਂ ਲੈਣ ਦੀ ਕੋਈ ਲੋੜ ਨਹੀਂ ਹੈਗੀ ਐ ਤੁਹਾਨੂੰ ਕੋਈ ਵੀ ਦਵਾਈਆਂ ਲੈਣ ਦੀ ਲੋੜ ਨਹੀਂ ਹੈਗੀ ਕੋਈ ਸਭ ਤੋਂ ਜਿਆਦਾ ਇਹ ਕਰੋ ਐਕਸਰਸਾਈਜ਼ ਕਰੋ ਵਧੀਆ ਤਰੀਕੇ ਨਾਲ ਫੋਲੋ ਕਰੋ ਤੁਸੀਂ ਖੜ ਘਰ ਦਾ ਖਾਣਾ ਖਾਓ ਬਾਹਰ ਦਾ ਬਿਲਕੁਲ ਵੀ ਨਹੀਂ ਖਾਣਾ ਹੈਗਾ ਤੇ ਘਰ ਦੀਆਂ ਸਬਜ਼ੀਆਂ ਉਬਾਲਣ ਤੋਂ ਜਿਆਦਾ ਨਾ ਉਹਦੇ ਵਿੱਚ ਨਾ ਮਸਾਲਾ ਨਹੀਂ ਪਾਣਾ ਹੈਗਾ ਆ ਬਿਲਕੁਲ ਵੀ ਐਕਚੁਲੀ ਗੱਲ ਸੁਣੋ ਹੁਣ ਤੁਸੀਂ ਦੋ ਦਿਨ ਬਾਅਦ ਫਿਰ ਆਈ ਹੋ ਮੇਰੇ ਕੋਲ ਠੀਕ ਹੈ ਮੈਂ ਅਗਰ ਤੁਹਾਨੂੰ ਨਹੀਂ ਰੁਕਦਾ ਪੇ ਮੈਂ ਦਵਾਈਆਂ ਦਊਗੀ ਪਰ ਤੂੰ ਹੀ ਪਹਿਲਾਂ ਇਹੀ ਕਰੋ ਠੀਕ ਹੈ ਹੁਣ ਅੱਛਾ ਠੀਕ ਹੋ ਗਿਆ ਨਾ ਠੀਕ ਹੋ ਗਿਆ ਪਰ ਤੁਹਾਨੂੰ ਹਲੇ ਵੀ ਐਕਸਰਸਾਈਜ ਯੋਗਾ ਕੁਛ ਛੱਡਣਾ ਨਹੀਂ ਹੈਗਾ ਇਹ ਤੁਹਾਡੀ ਬੋਡੀ ਨੂੰ ਤੰਦਰੁਸਤ ਰੱਖੂਗਾ ਠੀਕ ਹੈ ਤੁਸੀਂ ਕੁਝ ਵੀ ਚੀਜ਼ ਛੱਡ ਨਹੀਂ ਸਕਦੇ ਅੱਗਿਓ ਚਲੋ ਠੀਕ ਹ ਹੁਣ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੀਓ